ਹੈਲੋ ਹਾਂਜੀ ਹਾਂਜੀ ਵੋਲਵੋ ਬੱਸਾਂ ਦੀ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਦੇਖੋ ਜੀ ਸਾਡੀਆਂ ਬੱਸਾਂ ਅੰਮ੍ਰਿਤਸਰ ਲਾਗੇ ਲਾਗੇ ਜਿਹੜਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਜਲੰਧਰ ਪਠਾਨਕੋਟ ਗੁਰਦਾਸਪੁਰ ਅਤੇ ਆਲ ਓਵਰ ਪੰਜਾਬ ਦੇ ਅੱਗੇ ਤਲਵੰਡੀ ਭਾਈ ਮਖੂ ਜੀਰਾ ਮੋਗਾ ਬਠਿੰਡਾ ਇੱਧਰ ਸਾਡੇ ਸਾਰੇ ਬੱਸਾਂ ਚੱਲਦੀਆਂ ਨੇ ਇਸ ਏਰੀਏ ਦੇ ਵਿੱਚ ਅਤੇ ਇਹਨਾਂ ਦਾ ਟਾਈਮਿੰਗ ਹੈ ਜਿਹੜੀ ਪੀ ਇਹਨਾਂ ਦੀ ਕ ਅੱਧੇ ਘੰਟੇ ਦੀ ਸਰਵਿਸ ਹੈ ਬੱਸ ਦੀ ਟਾਈਮਿੰਗ ਦੀ ਅਤੇ ਤੁਸੀਂ ਉਸ ਤਰ੍ਹਾਂ ਸਾਡੀਆਂ ਬੱਸਾਂ ਆਲ ਓਵਰ ਇੰਡੀਆ ਵੀ ਚੱਲਦੀਆਂ ਨੇ ਹਾਂਜੀ ਅਸੀਂ ਤੁਹਾਨੂੰ ਤੁਹਾਡੇ ਇਸੇ ਨੰਬਰ 'ਤੇ ਨਾ ਆਪਸੀ ਵਟਸਐਪ ਲਿੰਕ ਭੇਜ ਦਿਆਂਗੇ ਅਤੇ ਤੁਸੀਂ ਉਹਦੇ ਤੋਂ ਸਾਡੀਆਂ ਬੱਸਾਂ ਦੀ ਜਾਣਕਾਰੀ ਲੈ ਸਕਦੇ ਜੇ ਕਦੋਂ ਤੁਰਨੀ ਹੈ ਕਿੱਧਰ ਨੂੰ ਤੁਰਨੀ ਤੁਸੀਂ ਵੀ ਉਹਦੇ 'ਤੇ ਚੈੱਕ ਕਰ ਲੈਣਾ ਜੀ ਠੀਕ ਹੈ ਜੀ ਅਤੇ ਉੱਥੇ ਤੁਹਾਨੂੰ ਪਤਾ ਲੱਗ ਜੇਗਾ ਅਤੇ ਟਾਈਮਿੰਗ ਸਾਰਾ ਕੁਝ ਡਿਟੇਲ ਉੱਥੇ ਆਵੇਗੀ ਉੱਥੇ ਤੁਸੀਂ ਬੁਕਿੰਗ ਪਾ ਲੈਣੀ ਹੈ ਜੀ ਮਿਹਰਬਾਨੀ ਜੀ